ਸਰਕਾਰ ਵੱਖ ਵੱਖ ਨੀਤੀਗਤ ਮੁੱਦਿਆਂ ਜਿਵੇਂ ਕਿ ਸਿੱਖਿਆ ਸਿਹਤ ਸੰਭਾਲ ਅਤੇ ਆਰਥਿਕਤਾ ਨੂੰ ਤਹਿਜ਼ੀਬ ਦਿੰਦੀ ਹੈ ਜਿੱਦਾਂ ਮਤਲਬ ਦਵਾਈਆਂ ਵਿੱਚ ਕਟੌਤੀ ਜਿੱਦਾਂ ਕਿ ਅਮੀਰ ਗਰੀਬ ਕਈ ਦਵਾਈਆਂ ਇੰਨੀਆਂ ਮਹਿੰਗੀਆਂ ਹੁੰਦੀਆਂ ਹਨ ਕਿ ਉਹ ਸਾਰੇ ਨਹੀਂ ਖਰੀਦ ਸਕਦੇ ਅਤੇ ਉਹਨਾਂ 'ਚ ਕਟੌਤੀ ਕਰਕੇ ਕਟੌਤੀ ਹੁੰਦੀ ਹੈ ਕਟੌਤੀ ਕਰਕੇ ਉਹ ਦਵਾਈ ਸਾਰੀ ਖਰੀਦ ਸਕਦੇ ਹਨ ਜਿੱਦਾਂ ਕਿ ਅਗਰ ਗਰੀਬ ਹੈ ਕੋਈ ਉਸਦੇ ਘਰ ਕੋਈ ਬਿਮਾਰ ਪਿਆ ਹੈ ਅਗਰ ਦਵਾਈ ਮਹਿੰਗੀ ਹੋਏਗੀ ਤਾਂ ਉਹ ਖਰੀਦ ਨਹੀਂ ਸਕੇਗਾ ਅਗਰ ਉਸ ਵਿੱਚ ਵੀ ਕਟੌਤੀ ਹੋ ਜਾਏਗੀ ਤਾਂ ਉਹ ਬਹੁਤ ਹੀ ਆਸਾਨੀ ਨਾਲ ਦਵਾਈ ਲੈ ਸਕਦਾ ਹੈ ਜਿਸ ਨਾਲ ਉਹ ਠੀਕ ਵੀ ਹੋ ਸਕਦੇ ਹਨ ਇੱਦਾਂ ਕਿ ਸਰਕਾਰ ਅਡੋਪਸ਼ਨ ਬਾਰੇ ਬਹੁਤ ਕਹਿੰਦੀ ਹੈ ਕਿ ਅਨਾਥ ਬੱਚੇ ਨੂੰ ਅਡੋਪਟ ਕਰੋ ਹੈ ਨਾ ਜਿੱਦਾਂ ਕਿ ਉਹਨਾਂ ਦਾ ਪਾਲਣ ਪੋਸ਼ਣ ਕਰੋ ਪਾਲਨ ਪੋਸ਼ਣ ਕਰਕੇ ਬਹੁਤ ਹੀ ਵਧੀਆ ਤਰੀਕਾ ਹੈ ਇਹ ਸਭ ਸਹੀ ਕਰਨ ਦਾ ਔਰ ਜਿਵੇਂ ਪਾਲਣ ਪੋਸ਼ਣ ਉਹਨਾਂ ਦਾ ਕਰਕੇ ਉਹਨਾਂ ਨੂੰ ਸਿੱਖਿਆ ਦਓ ਵਧੀਆ ਸਿੱਖਿਆ ਦੇ ਕੇ ਉਹਨਾਂ ਨੂੰ ਵੱਡੇ ਕਰਕੇ ਇਵੇਂ ਹੀ ਇੰਝ ਹੀ ਸਰਕਾਰ ਨੇ ਬਹੁਤ ਹੀ ਆਰਥਿਕਤਾ ਨੂੰ ਤਰਜ਼ੀਹ ਦਿੱਤੀ ਹੈ